ਅੱਜ ਦੇ ਸਮੇਂ ਵਿੱਚ ਇੰਟਰਨੈਟ ਨੇ ਬੈਂਕਿੰਗ ਅਤੇ ਪੈਸੇ ਦੀ ਲੈਣ ਦੇਣ ਦੇ ਤਰੀਕੇ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਆਪਣੀ ਜਗ੍ਹਾ ਤੋਂ ਹੀ ਕਿਸੇ ਨੂੰ ਵੀ ਦੂਰ ਦੁਰਾਡੇ ਬੈਠੇ ਇਨਸਾਨ ਨੂੰ ਵੀ ਪੈਸੇ ਭੇਜ ਦਿੰਦੇ ਹਨ ਅਤੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਜਿੱਥੇ ਕਿ ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਦੂਰ ਪੈਸੇ ਡਾਕ ਨਾਲ ਜਾਂ ਪੈਸੇ ਖੁਦ ਦੇਣ ਜਾਣਾ ਪੈਂਦਾ ਸੀ ਅੱਜ ਦੇ ਸਮੇਂ ਵਿੱਚ ਇੰਟਰਨੈਟ ਨਾਲ ਉਹ ਕੰਮ ਬਹੁਤ ਹੀ ਆਸਾਨ ਹੋ ਚੁੱਕਾ ਹੈ ਜਿਸ ਨਾਲ ਅਸੀਂ ਸਿਰਫ਼ ਅਤੇ ਸਿਰਫ਼ ਆਨਲਾਈਨ ਇੱਕ ਬਟਨ ਨਾਲ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹਾਂ ਲੇਕਿਨ ਇਹਨਾਂ ਕੰਮਾਂ ਵਿੱਚ ਬਹੁਤ ਹੀ ਰਿਸਕ ਵੀ ਹੈ ਕਈ ਵਾਰ ਪੈਸੇ ਕਿਸੇ ਗਲਤ ਜਗ੍ਹਾ ਪਹੁੰਚ ਜਾਂਦੇ ਹਨ ਅਤੇ ਕਈ ਵਾਰ ਪੈਸੇ ਦਾ ਫਰੋਡ ਵੀ ਹੋ ਜਾਂਦਾ ਹੈ ਜਿਸ ਨਾਲ ਬਹੁਤ ਹੀ ਲੋਕ ਅੱਜ ਦੇ ਸਮੇਂ ਵਿੱਚ ਬਰਬਾਦ ਵੀ ਹੋਏ ਹਨ ਅਤੇ ਮੈਂ ਜਿੱਥੇ ਤੱਕ ਮੇਰੀ ਗੱਲ ਹੈ ਮੈਂ ਅੱਜ ਵੀ ਪੈਸੇ ਦੀ ਲੈਣ ਦੇਣ